ਸਤਿ ਸ਼੍ਰੀ ਅਕਾਲ ਜੀ ਹਾਂਜੀ ਠੀਕ ਠਾਕ ਤੁਸੀਂ ਦੱਸੋ ਬੱਚੇ ਬਸ ਸਾਰੇ ਆਪਣੀ ਆਪਣੀਆਂ ਨੌਕਰੀਆਂ 'ਚ ਹਾਂਜੀ ਹਮ

ਇਹ ਇਹ ਰੁਝਾਨ ਰੁਝਾਨ ਵਧਿਆ ਪਿਆ ਕਿਉਂਕਿ ਇੱਥੇ ਰੁਜ਼ਗਾਰ ਦੇ ਉਨੇ ਸਾਧਨ ਹੈ ਨਹੀਂ ਹਮ ਕਰਨਾ ਹੀ ਪੈਣਾ ਹਾਂਜੀ ਜੋ ਖੁਦਾ ਨੂੰ ਮਨ ਜੋ ਰੱਬ ਨੂੰ ਮਨਜ਼ੂਰ ਹੋਊਗਾ

ਬਸ ਫਾਇਦਾ ਹੋਰ ਵੀ ਹੈ ਪੈਸਾ ਵੀ ਹੈ ਲਾਈਫ ਵੀ ਦਿਖਦੀ ਹੈ ਹਾਂਜੀ ਥੈਂਕ ਯੂ ਓਕੇ ਸਤਿ ਸ਼੍ਰੀ